ਹਾਂਜੀ ਅੱਜ ਆਪਾਂ ਗੱਲ ਕਰ ਰਹੇ ਹੈਗੇ ਵੀ ਭਵਿੱਖ ਵਿੱਚ ਪੰਜਾਬੀ ਭਾਸ਼ਾ ਨੂੰ ਕਿਵੇਂ ਅੱਗੇ ਵਧਾ ਸਕਦੇ ਹਾਂ ਕਿਵੇਂ ਸੁਰੱਖਿਅਤ ਰੱਖ ਸਕਦੇ ਹਾਂ ਇਹਦੇ ਲਈ ਆਪਾਂ ਪਹਿਲਾਂ ਥੋੜ੍ਹੀ ਜਿਹੀ ਪਿਛੋਕੜ ਦੀ ਗੱਲ ਕਰ ਲਈਏ ਜਿਵੇਂ ਪੰਜਾਬੀ ਭਾਸ਼ਾ ਜੋ ਆਪਣੀ ਵੈਦਿਕ ਸੰਸਕ੍ਰਿਤ ਚੋਂ ਨਿਕਲੀ ਹੋਈ ਭਾਸ਼ਾ ਗੀ ਹੋਰ ਵੀ ਬਹੁਤ ਸਾਰੀਆਂ ਲਿਪੀਆਂ ਆਈਆਂ ਜਿਵੇਂ ਸ਼ੋਰ ਸ਼ਾਈਨੀ ਕੈਕਈ ਟਾਕਰੀ ਪੈਸਾਚੀ ਆਈ ਅਤੇ ਇਹਨਾਂ ਦੇ ਵਿੱਚੋਂ ਨਿਕਲੀ ਹੋਈ ਲਿਪੀ ਦੇ ਲਿਪੀਆਂ ਦੇ ਵਿੱਚੋਂ ਨਿਕਲੀ ਹੋਈ ਇੱਕ ਭਾਸ਼ਾ ਬਣੀ ਹੈ ਪੰਜਾਬੀ ਭਾਸ਼ਾ ਇਸ ਭਾਸ਼ਾ ਨੂੰ ਜੋ ਇੱਕ ਨਿਯਮ ਵੱਧ ਰੂਪ ਦਿੱਤਾ ਸਾਡੇ ਦੂਜੇ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਬਣਾਈ ਉਹਨਾਂ ਨੇ ਸਾਨੂੰ ਪੰਜਾਬੀ ਲਿਖਣ ਦੇ ਲਈ ਉਹਨਾਂ ਨੇ ਚਿੰਨ੍ਹ ਦਿੱਤੇ ਪੈਂਤੀ ਦਿੱਤੀ ਪੈਂਤੀ ਅੱਖਰੀ ਦਿੱਤੀ ਅਤੇ ਜੇਕਰ ਆਪਾਂ ਗੱਲ ਗੁਰਬਾਣੀ ਦੀ ਗੱਲ ਕਰੀਏ ਤਾਂ ਗੁਰਬਾਣੀ ਦੀ ਜੋ ਭਾਸ਼ਾ ਗੀ ਜੋ ਲਿਪੀ ਵਰਤੀ ਗਈ ਹੈ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਦੇ ਵਿੱਚ ਲਿਖੀ ਗਈ ਹੈ ਸਾਡੇ ਗੁਰੂ ਸਾਹਿਬਾਨਾਂ ਤੋਂ ਲੈ ਕੇ ਹੁਣ ਤੱਕ ਪੰਜਾਬੀ ਦਾ ਬਹੁਤ ਹੀ ਮਹੱਤਵ ਰਿਹਾ ਸਾਡੀ ਜ਼ਿੰਦਗੀ ਦੇ ਵਿੱਚ ਸਾਡੀ ਸਿੱਖਿਆ ਦੇ ਵਿੱਚ ਬੇਸ਼ੱਕ ਸਿੱਖਿਆ ਦਾ ਕੋਈ ਵੀ ਖੇਤਰ ਹੋਵੇ ਜੇਕਰ ਆਪਾਂ ਛੋਟੇ ਬੱਚੇ ਦੀ ਗੱਲ ਕਰੀਏ ਜਿੰਨਾਂ ਚਿਰ ਬੱਚਾ ਆਪਣੀ ਮਾਤ ਭਾਸ਼ਾ ਦੇ ਵਿੱਚ ਪੜ੍ਹਨਾ ਲਿਖਣਾ ਨਹੀਂ ਸਿੱਖਦਾ ਉੱਨਾਂ ਚਿਰ ਉਸ ਬੱਚੇ ਦੀ ਤਰੱਕੀ ਨਹੀਂ ਹੋ ਸਕਦੀ ਬੌਧਿਕ ਵਿਕਾਸ ਨਹੀਂ ਹੋ ਸਕਦਾ ਠੀਕ ਹੈ ਹੁਣ ਆਪਾਂ ਅੱਜ ਕੱਲ੍ਹ ਗੱਲ ਕਰ ਰਹੇ ਹਾਂ ਕਿ ਵੀ ਭਾਸ਼ਾ ਮਰ ਰਹੀ ਆ ਪੰਜਾਬੀ ਭਾਸ਼ਾ ਮਰ ਰਹੀ ਆ ਪਰ ਮਰਨ ਦਾ ਕਾਰਨ ਕੀ ਆ ਮਰਨ ਦਾ ਕਾਰਨ ਇਹ ਹੈ ਕਿ ਹੋਰ ਪੱਛਮੀ ਭਾਸ਼ਾਵਾਂ ਦਾ ਜੋ ਦਬਾਅ ਸਾਡੇ ਉੱਪਰ ਵੱਧ ਰਿਹਾ ਗਾ ਜਿੱਦਾਂ ਗੱਲ ਕਰ ਲਈਏ ਆਪਾਂ ਅੰਗਰੇਜ਼ੀ ਭਾਸ਼ਾ ਦਾ ਲੋਕ ਫਰੈਂਚ ਸਿੱਖ ਰਹੇ ਨੇ ਸਪੈਨਿਸ਼ ਸਿੱਖ ਰਹੇ ਨੇ ਪਰ ਕੀ ਫਰੈਂਚ ਅਤੇ ਸਪੈਨਿਸ਼ ਨੂੰ ਸਮਝਣ ਦੇ ਲਈ ਪੰਜਾਬੀ ਭਾਸ਼ਾ ਦੀ ਜ਼ਰੂਰਤ ਨਹੀਂ ਉਹਨਾਂ ਦਾ ਪੰਜਾਬੀ ਵਿੱਚ ਅਨੁਵਾਦ ਕਰਨਾ ਜਾਂ ਪੰਜਾਬੀ ਵਿੱਚ ਤਰਜਮਾ ਕੀਤੇ ਬਿਨਾਂ ਅਸੀਂ ਉਹਨੂੰ ਸਮਝ ਸਕਦੇ ਹਾਂ ਨਹੀਂ ਬਿਲਕੁਲ ਨਹੀਂ ਸਮਝ ਸਕਦੇ ਆਪਾਂ ਉਸਨੂੰ ਸੋ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਵੀ ਪੰਜਾਬੀ ਭਾਸ਼ਾ ਨੂੰ ਕਿਵੇਂ ਬਚਾਇਆ ਜਾ ਸਕਦਾ ਤਾਂ ਇਹਦਾ ਸਭ ਤੋਂ ਪਹਿਲਾ ਜੋ ਉਪਾਅ ਉਹ ਆ ਬੱਚਿਆਂ ਨੂੰ ਗੁਰਬਾਣੀ ਦੇ ਲੜ ਲਾਉਣਾ ਠੀਕ ਹੈ ਜੀ ਕਿਉਂਕਿ ਗੁਰਬਾਣੀ ਹੀ ਬੱਚਿਆਂ ਨੂੰ ਆਪਣੀ ਮਾਤ ਭਾਸ਼ਾ ਦੇ ਨਾਲ ਜੋੜ ਕੇ ਰੱਖ ਸਕਦੀ ਹੈ ਉਸ ਤੋਂ ਬਾਅਦ ਗੱਲ ਕਰੀਏ ਕਿ ਬੱਚੇ ਨੂੰ ਜੋ ਵੀ ਪ੍ਰਾਇਮਰੀ ਸਿੱਖਿਆ ਗੀ ਛੇ ਤੋਂ ਚੌਦ੍ਹਾਂ ਸਾਲ ਤੱਕ ਦੇ ਬੱਚੇ ਨੇ ਉਹਨਾਂ ਨੂੰ ਜਿਹੜੀ ਸਿੱਖਿਆ ਉਹਨਾਂ ਦੀ ਮਾਤ ਭਾਸ਼ਾ ਦੇ ਵਿੱਚ ਦਵਾਈ ਜਾਵੇ ਕਿਉਂ ਤਾਂ ਜੋ ਉਹ ਆਪਣੀ ਉਸ ਭਾਸ਼ਾ ਨੂੰ ਸਮਝ ਸਕਣ ਉਸ ਤੋਂ ਜਾਣੂ ਹੋ ਸਕਣ ਠੀਕ ਹੈ ਜੀ ਸਭ ਤੋਂ ਵੱਡੇ ਇਹੀ ਦੋ ਉਪਾਅ ਨੇ ਜਿਸ ਤਰ੍ਹਾਂ ਪੰਜਾਬੀ ਭਾਸ਼ਾ ਨੂੰ ਪੰਜਾਬੀ ਹੀ ਨਹੀਂ ਆਪਾਂ ਕਿਸੇ ਵੀ ਭਾਸ਼ਾ ਨੂੰ ਇਸੇ ਤਰ੍ਹਾਂ ਹੀ ਸੁਰੱਖਿਅਤ ਰੱਖ ਸਕਦੇ ਹਾਂ ਅਤੇ ਭਵਿੱਖ ਵਿੱਚ ਅੱਗੇ ਵਧਾ ਸਕਦੇ ਹਾਂ